ਜੋ ਵਿਅਕਤੀ ਯੋਗਾ ਦੇ ਅਭਿਆਸ ਵਿੱਚ ਨਵਾਂ ਹੈ ਸਭ ਤੋਂ ਪਹਿਲੇ ਤਾਂ ਮੈਂ ਉਸਨੂੰ ਯੋਗਾ ਦੇ ਕਈ ਨਾਮ ਦੱਸੂੰਗੀ ਜਿਵੇਂ ਕਿ ਭੁਜੰਗ ਆਸਨ ਬਲ ਆਸਨ ਵਜਰ ਆਸਨ ਕਪਾਲ ਭਾਰਤੀ ਲੋਕ ਇਸ ਯੋਗਾ ਨੂੰ ਕਰਨ ਲਈ ਸਵੇਰੇ ਤਾਜ਼ੀ ਹਵਾ ਵਿੱਚ ਪਾਰਕ ਵਿੱਚ ਜਾ ਕੇ ਵੀ ਕਰ ਸਕਦੇ ਹਨ ਯੋਗਾ ਕਰਨ ਨਾਲ ਤਾਂ ਕਈ ਸਾਰੀਆਂ ਬਿਮਾਰੀਆਂ ਵੀ ਦੂਰ ਹੁੰਦੀਆਂ ਹਨ ਲੋਕ ਇਸ ਨੂੰ ਕਰਨ ਨਾਲ ਤੰਦਰੁਸਤ ਅਤੇ ਤਕੜੇ ਵੀ ਰਹਿੰਦੇ ਹਨ ਯੋਗਾ ਨੂੰ ਤਾਂ ਇੱਕ ਬੱਚਾ ਜਵਾਨ ਬੁੱਢਾ ਆਦਮੀ ਵੀ ਕਰ ਸਕਦਾ ਹੈ ਯੋਗਾ ਕਰਨ ਨਾਲ ਲੋਕਾਂ ਦੀ ਸਿਹਤ ਬਿਲਕੁਲ ਹੀ ਸਹੀ ਰਹਿੰਦੀ ਹੈ ਲੋਕਾਂ ਦੀ ਕਈ ਬਿਮਾਰੀਆਂ ਜਿਵੇਂ ਕਿ ਸ਼ੂਗਰ ਬੀ ਪੀ ਲੋਕ ਇਸ ਬਿਮਾਰੀਆਂ ਤੋਂ ਵੀ ਛੁਟਕਾਰਾ ਪਾ ਲੈਂਦੇ ਹਨ ਯੋਗਾ ਕਰਨ ਨਾਲ ਯੋਗਾ ਕਰਨ ਲਈ ਲੋਕ ਤਾਂ ਅੱਜ ਕੱਲ੍ਹ ਸਪੈਸ਼ਲ ਯੋਗਾ ਦੀ ਜਮਾਤਾਂ ਵੀ ਜ ਜਾਂਦੇ ਹਨ ਜਿਸ ਦੇ ਲੋਕ ਫੀਸਾਂ ਵੀ ਭਰਦੇ ਹਨ